ਸਤਿ ਸ਼੍ਰੀ ਅਕਾਲ ਜੀ ਜਦੋਂ ਮੈਂ ਪਹਿਲੀ ਵਾਰੀ ਜੀ ਬਠਿੰਡੇ ਸ਼ਿਫਟ ਹੋਇਆ ਸੀ ਉਦੋਂ ਮੈਥੋਂ ਆ ਕੇ ਕੈਬ ਕੀਤੀ ਸੀ ਅਤੇ ਐਡਰਸ ਦਾ ਮੈਨੂੰ ਪਤਾ ਨਹੀਂ ਸੀ ਕੰਫਰਮ ਵੀ ਹੈਗਾ ਕਿੱਥੇ ਹੈ ਇਹ ਅਤੇ ਮੈਂ ਮੱਤੀ ਦਾਸ ਨਗਰ ਦੇ ਵਿੱਚ ਘਰ ਲਿਆ ਸੀ ਆਨਲਾਈਨ ਹੀ ਮੇਰੇ ਫਰੈਂਡ ਨੇ ਲੇ ਲੇ ਕੇ ਉੱਤੇ ਛੱਡਿਆ ਹੋਇਆ ਸੀ ਅਤੇ ਮੈਨੂੰ ਐਗਜੈਕਟ ਉਹਦੀ ਲੋਕੇਸ਼ਨ ਦਾ ਪਤਾ ਹੈਗਾ ਨਹੀਂ ਸੀ ਅਤੇ ਫਿਰ ਮੈਂ ਕੈਬ ਕੀਤੀ ਅਤੇ ਉਹਨੂੰ ਮੈਂ ਮੇਰੀ ਲੋਕੇਸ਼ਨ ਦੱਸੀ ਅਤੇ ਉਹ ਮੈਨੂੰ ਆਰਾਮ ਨਾਲ ਸ਼ੋਰਟਕੱਟ ਕਰਕੇ ਮੈਨੂੰ ਛੇਤੀ ਤੋਂ ਛੇਤੀ ਉੱਥੇ ਲੈ ਗਿਆ ਅਤੇ ਨਾਲੇ ਰਾਹ ਦੇ ਵਿੱਚ ਜਿਵੇਂ ਮੈਨੂੰ ਕੋਈ ਚੀਜ਼ ਦੀ ਲੋੜ ਸੀਗੀ ਪਾਣੀ ਪੀਣਾ ਸੀ ਮੈਂ ਹੋਰ ਕੋਈ ਚੀਜ਼ ਕਰਨੀ ਸੀ ਉਹਨੇ ਬਾਰ ਬਾਰ ਮੇਰੇ ਲਈ ਤਿੰਨ ਚਾਰ ਵਾਰ ਗੱਡੀ ਵੀ ਰੋਕੀ ਅਤੇ ਇੰਨਾ ਸੌਫਟਲੀ ਉਹ ਚਲਾ ਕੇ ਗਿਆ ਬਾਲਾ ਵਧੀਆ ਡਰਾਈਵਰ ਸੀ ਅਤੇ ਉਹਦੀਆਂ ਗੱਲਾਂ ਇੰਨੀਆਂ ਮੈਨੂੰ ਵਧੀਆ ਲੱਗੀਆਂ ਕਿ ਉਹਨੇ ਮੈਨੂੰ ਜਮਾਂ ਹੀ ਫੀਲ ਨਹੀਂ ਹੋਣ ਦਿੱਤਾ ਕਿ ਮਤਲਬ ਉਹ ਬੰਦਾ ਵੀ ਮੈਂ ਅਨਨੋਨ ਆ ਉਹ ਬੰਦੇ ਦੇ ਲਈ ਅਤੇ ਅਜਨਬੀ ਮੈਂ ਫੀਲ ਨਹੀਂ ਕੀਤਾ ਮੈਂ ਪੂਰਾ ਸੇਫ ਫੀਲ ਕੀਤਾ ਵੀ ਇਹ ਬੰਦਾ ਜਮਾਂ ਸਹੀ ਹੈਗਾ ਅਤੇ ਮੈਨੂੰ ਸਹੀ ਥਾਂ 'ਤੇ ਟਾਈਮ ਨਾਲ ਛੱਡ ਦਊਗਾ ਅਤੇ ਉਹਨੇ ਉਹੋ ਹੀ ਕੀਤਾ ਅਤੇ ਹੁਣ ਮੈਂ ਦੁਬਾਰਾ ਵੀ ਚਾਹੁੰਦਾ ਵੀ ਉਸ ਬੰਦੇ ਦਾ ਧੰਨਵਾਦ ਕਰਨਾ ਅਤੇ ਉਹਦੇ ਬਾ ਉਹਦੇ ਨਾਲ ਦੁਬਾਰਾ ਜੇ ਕਦੇ ਆਉਣਾ ਪਿਆ ਤਾਂ ਮੈਂ ਉਹਦੀ ਗੱਡੀ 'ਚ ਹੀ ਸਫਰ ਕਰਨਾ ਪਰੈਫਰ ਕਰਾਂਗਾ ਜੀ